ਰੂਪਨਗਰ ਜ਼ਿਲ੍ਹੇ ਦੇ ਵਿੱਚ ਮੌਸਮ ਵਰਖਾ ਦਾ ਹੈ ਹਾਂ ਮੈਂ ਇਸ ਸਮੇਂ ਵਿੱਚ ਕਠੋਰ ਹੜਾਂ ਨੂੰ ਵੇਖਿਆ ਹੈ ਇਸ ਸਮੇਂ ਵਰਖਾ ਦੇ ਕਾਰਨ ਹਨੇਰੀ ਦੇ ਕਾਰਨ ਘਰਾਂ ਵਿੱਚ ਲਾਈਟ ਚੱਲ ਜਾਂਦੀ ਹੈ ਫਿਰ ਚੌਵੀ ਘੰਟੇ ਤੱਕ ਲਾਈਟ ਨਾ ਆਉਣ ਕਾਰਨ ਪਾਣੀ ਵੀ ਨਹੀਂ ਆਉਂਦਾ ਅਤੇ ਘਰਾਂ ਦੇ ਵਿੱਚ ਭਾਰੀ ਬਰਸਾਤ ਕਾਰਨ ਘਰਾਂ ਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਾਰਨ ਲੋਕ ਬਾਹਰ ਆਉਣਾ ਜਾਣਾ ਨਹੀਂ ਕਰ ਪਾਉਂਦੇ